ਕੰਮ ਕਾਰ ਤੋਂ ਇਲਾਵਾ ਮੇਰੇ ਕਈ ਸਾਰੇ ਸ਼ੌਂਕ ਨੇ ਜਿਹਨਾਂ ਨੂੰ ਮੈਂ ਇੱਕ ਇੱਕ ਕਰਕੇ ਦੱਸਣਾ ਚਾਹਵਾਂਗਾ ਜਿਵੇਂ ਕਿ ਹੈਲਥ ਹੈਲਥ ਦੇ ਵਿੱਚ ਮੈਂ ਸਵੇਰੇ ਦੋ ਟਾਈਮ ਜਿੰਮ ਜਾਂਦਾ ਸਵੇਰੇ ਸ਼ਾਮ ਦੋ ਦੋ ਘੰਟੇ ਜਿੱਥੇ ਮੈਂ ਕਾਫੀ ਸਾਰੀ ਐਕਸਸਾਈਜ਼ ਕਰਦਾਂ ਰਨਿੰਗ ਕਰਦਾਂ ਐਕਸਸਾਈਜ਼ ਹੋਗੀਆਂ ਅਤੇ ਮੈਂ ਹੈਲਦੀ ਖਾਣਾ ਹੀ ਪਸੰਦ ਕਰਦਾ ਹਾਂ ਖੀਰਾ ਸਬਜ਼ੀਆਂ ਕੱਚੀ ਸਬਜ਼ੀਆਂ ਅਤੇ ਦੂਜੇ ਨੰਬਰ 'ਤੇ ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਆ ਮੈਂ ਨਵੀਂ ਨਵੀਂ ਜਗ੍ਹਾ ਘੁੰਮਦਾ ਆਂ ਟ੍ਰੈਵਲ ਕਰਦਾਂ ਅਤੇ ਉੱਥੇ ਜਾ ਕੇ ਪਿਕਸ ਕਲਿੱਕ ਕਰਦਾ ਹਾਂ ਉਹਨਾਂ ਨੂੰ ਮੈਂ ਆਪਣੀ ਯਾਦਾਂ ਵਿੱਚ ਕੈਦ ਕਰਕੇ ਰੱਖਦਾ ਹਾਂ ਹੋਰ ਵੀ ਬਹੁਤ ਸਾਰੀ ਕੁਦਰਤ ਦੀਆਂ ਫੋਟੋਆਂ ਖਿੱਚਣ ਦਾ ਮੈਨੂੰ ਸ਼ੌਂਕ ਆ ਅਤੇ ਚੌਥੇ ਨੰਬਰ 'ਤੇ ਮੈਨੂੰ ਆਪਣੇ ਯਾਰਾਂ ਦੋਸਤਾਂ ਨਾਲ਼ ਵੀ ਬੈਠਣਾ ਉੱਠਣਾ ਵਧੀਆ ਲੱਗਦਾ ਕਿ ਮਾਇੰਡ ਫ੍ਰੈਸ਼ ਹੋ ਜਾਂਦਾ ਆ ਘੁੰਮ ਫਿਰ ਕੇ ਅਤੇ ਬੁੱਕਸ ਪੜ੍ਹਨ ਦਾ ਵੀ ਮੈਨੂੰ ਸ਼ੌਂਕ ਹੈਗਾ ਫ੍ਰੀ ਸਮੇਂ 'ਚ ਮੈਂ ਬੁੱਕ ਪੜ੍ਹਦਾ ਹਾਂ ਬੁੱਕ ਪੜ੍ਹ ਕੇ ਵੀ ਸਾਨੂੰ ਕਾਫੀ ਕੁਝ ਪਤਾ ਲੱਗਦਾ ਨੌਲੇਜ ਮਿਲਦੀ ਆ ਅ ਸਾਡੀ ਜ਼ਿੰਦਗੀ 'ਚ ਮੋੜ ਆਉਂਦੇ ਨੇ ਸਾਨੂੰ ਨੌਲੇਜ ਮਿਲਦੀ ਆ ਬੁੱਕਸ ਤੋਂ ਵੀ